ਹਾਂ ਸਾਡੇ ਖੇਤਰ ਦੇ ਹਸਪਤਾਲਾਂ ਦੀ ਗੱਲ ਕਰੀਏ ਤਾਂ ਸਾਡਾ ਪਿੰਡ ਸ਼ਹਿਰ ਤੋਂ ਕਾਫ਼ੀ ਦੂਰ ਹੋਣ ਦਾ ਕਰਕੇ ਸਾਨੂੰ ਇੱਥੇ ਲਾਗੇ ਦੇ ਹੋਸਪੀਟਲਾਂ ਦੇ ਉੱਤੇ ਹੀ ਨਿਰਭਰ ਹੋਣਾ ਪੈਂਦਾ ਹੈ ਕਿਉਂਕਿ ਸ਼ਹਿਰ ਦੂਰ ਹੋਣ ਦਾ ਕਰਕੇ ਐਮਰਜੈਂਸੀ ਦੇ ਤੌਰ 'ਤੇ ਸ਼ਹਿਰ ਇੰਨੀ ਜਲਦੀ ਨਹੀਂ ਪਹੁੰਚਿਆ ਜਾ ਸਕਦਾ ਐਮਰਜੈਂਸੀ ਦੀ ਹਾਲਤ ਦੇ ਵਿੱਚ ਅਤੇ ਜੇ ਗੱਲ ਕਰੀਏ ਬਿਸਤਰਿਆਂ ਦੀ ਆਕਸੀਜਨ ਦੇ ਸਿਲੰਡਰਾਂ ਦੀ ਜਿਹੜੇ ਸਰਕਾਰੀ ਹੋਸਪੀਟਲ ਆ ਇਹਨਾਂ ਦੇ ਵਿੱਚ ਬਿਸਤਰਿਆਂ ਦਾ ਤਾਂ ਬਹੁਤ ਬੁਰਾ ਹੀ ਹਾਲ ਹੈ ਅਤੇ ਸਰਜੀਕਲ ਔਜ਼ਾਰਾ ਦੀ ਤਾਂ ਚਲੋ ਇੱਥੇ ਜ਼ਰੂਰਤ ਨਹੀਂ ਪੈਂਦੀ ਇਹਨਾਂ ਨੂੰ ਕਿਉਂਕਿ ਇਹ ਇੱਥੋਂ ਰੈਫਰ ਕਰ ਦਿੰਦੇ ਆ ਕਹਿਣਗੇ ਵੀ ਅਸੀਂ ਸ਼ਹਿਰ ਚੱਲ ਜਾਓ ਉੱਥੇ ਜਾ ਕੇ ਆਪਣਾ ਇਲਾਜ਼ ਕਰਵਾਓ ਅਤੇ ਹੋਰ ਵੀ ਕਾਫ਼ੀ ਘਟਨਾਵਾਂ ਜਿਸ ਤਰ੍ਹਾਂ ਪਿੱਛੇ ਜਿਹੇ ਕਰੋਨਾ ਆਇਆ ਸੀ ਕਰੋਨੇ ਦੇ ਵਿੱਚ ਇਹਨਾਂ ਨੂੰ ਡਾਕਟਰਾਂ ਦੀ ਡਾਕਟਰਾਂ ਦੀ ਮੌਜ਼ੂਦਗੀ ਘੱਟ ਹੋਣ ਕਰਕੇ ਕੁਝ ਆਕਸੀਜਨ ਦੀ ਕਮੀ ਹੋਣ ਕਰਕੇ ਕਾਫ਼ੀ ਮੌਤਾਂ ਹੋਈਆਂ ਕਾਫ਼ੀ ਮੌਤਾਂ ਹੋਣ ਤੋਂ ਬਾਅਦ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੱਥੇ ਇਹਨਾਂ ਕੋਲ ਨਾ ਤਾਂ ਵੈਂਟੀਲੇਟਰ ਸੀ ਅਤੇ ਨਾ ਕੋਈ ਚੰਗੀ ਤਰ੍ਹਾਂ ਦੇ ਕੋਈ ਪ੍ਰਬੰਧ ਹੈਗਾ ਸੀ ਜਿਹਦੇ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕੇ